ਪੰਜ ਅ ਮੈਂ ਅਤੁਲ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਪੰਜਾਬ ਆਮ ਤੌਰ 'ਤੇ ਇੱਕ ਸਿਰਫ਼ ਮੈਦਾਨੀ ਇਲਾਕਾ ਹੀ ਹੈ ਲੇਕਿਨ ਇੱਥੇ ਕਈ ਸੁੰਦਰ ਸੁੰਦਰ ਜਗ੍ਹਾਵਾਂ ਹੈ ਜਿੱਦਾਂ ਕਿ ਸ਼ਿਵਾਲਿਕ ਮਾਊਂਟਨ ਰੇਂਜ ਜੋ ਕਿ ਘੱਗਰ ਨਦੀ ਦੇ ਨਾਲ ਹਨ ਹੋਰ ਵੀ ਕਈ ਸੁੰਦਰ ਜਗ੍ਹਾਵਾਂ ਜਿੱਦਾਂ ਕੀ ਮਿਨੀ ਗੋਆ ਜੋ ਕਿ ਪਠਾਨਕੋਟ 'ਚ ਹੈ ਅਤੇ ਪਠਾਨਕੋਟ ਖੁਦ ਵੀ ਇੱਕ ਪਿਹਾੜੀ ਇਲਾਕਾ ਹੈ ਜੋ ਕਿ ਇੱਕ ਬਹੁਤ ਹੀ ਸੁੰਦਰ ਪਹਾੜੀ ਇਲਾਕਾ ਹੈ ਮੈਂ ਕਿਉਂਕਿ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਮੇਰੇ ਨਾਲ ਗੁਰਦਾਸਪੁਰ ਤੋਂ ਥੋੜ੍ਹੀ ਹੀ ਦੂਰ ਹੈ ਪਠਾਨਕੋਟ ਇਸ ਕਰਕੇ ਮੈਂ ਆਮ ਤੌਰ 'ਤੇ ਹੀ ਪਠਾਨਕੋਟ ਜਾਇਆ ਕਰਦਾ ਹਾਂ ਉੱਥੇ ਸਿਰਫ਼ ਪਹਾੜੀ ਇਲਾਕਾ ਵੇਖਣ ਲਈ ਜਿੱਥੇ ਕਿ ਛੋਟੇ ਛੋਟੇ ਪਹਾੜ ਹਨ ਜਿੰਨ੍ਹਾਂ 'ਤੇ ਕਿ ਮੈਂ ਟਰੈਕ 'ਤੇ ਵੀ ਜਾਂਦਾ ਹੁੰਦਾ ਹਾਂ ਮਿੰਨੀ ਗੋਆ ਵੀ ਇੱਕ ਬਹੁਤ ਹੀ ਸੁੰਦਰ ਜੋ ਕਿ ਲੋਕਾਂ ਲਈ ਜਾਂ ਟੂਰਿਸਟਾਂ ਲਈ ਵੀ ਇੱਕ ਕੇਂਦਰ ਹੈ ਪੰਜਾਬ ਵਿੱਚ ਆਉਣ ਦਾ ਉੱਥੇ ਆਉਂਦੇ ਹਨ ਅਤੇ ਉਹ ਵੀ ਖੁਦ ਆਨੰਦ ਮਾਣਦੇ ਹਨ ਕਿ ਇੱਕ ਬਹੁਤ ਹੀ ਸੁੰਦਰ ਜਗ੍ਹਾ ਹੈ ਜਿੱਥੋਂ ਕਿ ਬਹਿ ਕੇ ਪਹਾੜਾਂ ਦਾ ਨਜ਼ਾਰਾ ਵੇਖਣ ਦਾ ਆਨੰਦ ਹੀ ਆ ਜਾਂਦਾ ਹੈ ਉਸ ਤੋਂ ਇਲਾਵਾ ਲੋਕ ਹੋਰ ਵੀ ਕਈ ਪਹਾੜਾਂ ਹੋਰ ਵੀ ਕਈ ਚੀਜ਼ਾਂ ਹਨ ਜੋ ਕਿ ਪੰਜਾਬ ਨੂੰ ਬਹੁਤ ਸੁੰਦਰ ਬਣਾਉਂਦੀਆਂ ਹਨ ਜਿੱਦਾਂ ਕਿ ਪੰਜਾਬ ਦੀ ਨਦੀਆਂ ਇਸ ਕਰਕੇ ਪੰਜਾਬ ਇੱਕ ਬਹੁਤ ਹੀ ਸੁੰਦਰ ਜਗ੍ਹਾ ਹੈ